ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਅਰੁਨਾ ਬੋਲ ਰਹੀ ਹਾਂ ਮੈਂ ਘਰ 'ਚ ਬੂਟੇ ਲਗਾਏ ਦੇ ਹੈ ਫਰੂਟ ਦੇ ਫਿਰ ਸਬਜ਼ੀਆਂ ਫਿਰ ਫੁੱਲ ਫ਼ਲ ਜੋ ਵੀ ਵੇਲਾਂ ਵੂਲਾਂ ਲਗਾਈ ਦੀਆਂ ਪਰ ਉਨ੍ਹਾਂ ਦਾ ਸਾਹਮਣਾ ਮੈਨੂੰ ਬੜਾ ਕਰਨਾ ਪੈਂਦਾ ਉਹਦੇ ਇਸ ਕਰਕੇ ਵੀ ਕਿਨਾ ਨੀ ਉਨ੍ਹਾਂ ਨੂੰ ਕੀੜਾ ਬੜੀ ਛੇਤੀ ਲੱਗ ਜਾਂਦਾ ਅਤੇ ਗਰਮੀਆਂ ਹੋਣ ਭਾਵੇਂ ਸਰਦੀਆਂ ਹੋਣ ਕੀੜਾ ਲੱਗਦਾ ਹੀ ਲੱਗਦਾ ਕਦੇ ਕਦਾਨੀ ਕੋਈ ਦਵਾਈ ਲਿਆ ਕਦੇ ਕੁਛ ਲਿਆ ਕਦੇ ਕੁਛ ਲਿਆ ਪਾਉਂਦੀ ਹਾਂ ਪਰ ਜਦੋਂ ਵੀ ਕਈ ਵਾਰ ਪਿਛਲੀ ਵਾਰ ਲਗਾਏ ਸੀ ਉਹ ਸਾਰੇ ਜਦੋਂ ਵੇਲਾਂ ਤਾਂ ਬਹੁਤ ਸੋਹਣੀਆਂ ਹੋਈਆਂ ਅਤੇ ਜਦੋਂ ਸਬਜ਼ੀ ਸੁਬਜ਼ੀਆਂ ਲੱਗੀਆਂ ਤਾਂ ਉਹ ਖ਼ਰਾਬ ਕੀੜਾ ਲੱਗ ਗਿਆ ਸਾਰਾ ਕਿਨਾ ਨੀ ਉਹ ਖ਼ਰਾਬ ਹੋ ਗਿਆ ਅਤੇ ਹੁਣ ਮੈਂ ਕਿਨਾ ਨੀ ਕਰਦੀ ਪਈ ਹਾਂ ਵੀ ਕਿਨਾ ਨੀ ਫਿਰ ਦਵਾਈ ਮੰਗਵਾਈ ਹੈ ਗਰਮੀ ਹੋਵੇ ਸਰਦੀ ਹੋਵੇ ਸਾਹਮਣਾ ਬੜਾ ਕਰਨਾ ਪੈਂਦਾ ਉਹ ਸਾਂਭ ਸੰਭਾਲ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦੀ ਹੈ ਕਦੀ ਰੂੜੀ ਪਾ ਕਦੇ ਕਿਨਾ ਨੀ ਜ਼ਹਿਰੀਲੀਆਂ ਚੀਜ਼ਾਂ ਜਿਹੜੀਆਂ ਕਹਿੰਦੇ ਵੀ ਉਹ ਵੀ ਪਾਉਣੀਆਂ ਪੈਂਦੀਆਂ ਪੀ ਉਹਦੇ ਨਾਲ ਕੀੜਾ ਨਹੀਂ ਲੱਗਦਾ ਖਾਦ ਖੂਦ ਜੋ ਵੀ ਹੈ ਉਹ ਸਾਰਾ ਕੁਛ ਪਾਉਂਦੀ ਹਾਂ ਪਰ ਬੜਾ ਮੁਸ਼ਕਿਲ ਹੈਗਾ ਉਹਨਾਂ ਨੂੰ ਇਹ ਵਾ ਕ ਜਦੋਂ ਕਿਨਾ ਨੀ ਉਹ ਸ਼ੁਰੂ ਹੁੰਦਾ ਬਹੁਤ ਸੋਹਣੇ ਲੱਗਦੇ ਹਰਿਆਲੀ ਬਹੁਤ ਵਧੀਆ ਲੱਗਦੀ ਹੈ ਅਤੇ ਜਦੋਂ ਫੁੱਲ ਪੈਂਦੇ ਜਾਂ ਕੁਛ ਵੀ ਪੈਂਦਾ ਉਹ ਸਾਰਾ ਹੀ ਖ਼ਰਾਬ ਹੋ ਜਾਂਦਾ ਉਹ ਫਿਰ ਕਿਨਾ ਨੀ ਦਵਾਈਆਂ ਲਿਆ ਕਦੇ ਕੋਈ ਕੋਈ ਦਵਾਈ ਕਦੇ ਕੋਈ ਉਹ ਲਿਆ ਕੇ ਤੇ ਪਾਉਂਦੀ ਹਾਂ ਤੇ ਕਿਨਾ ਨੀ ਐਹ ਵਾ ਵੀ ਕਿਨਾ ਨੀ ਕੀ ਕਰੇ ਕੋਈ ਬੜੀ ਪ੍ਰੇਸ਼ਾਨੀ ਆ ਗਰਮੀਆਂ ਹੋਣ ਸਰਦੀਆਂ ਹੋਣ ਸਾਰਾ ਹੀ ਕੰਮ ਖ਼ਰਾਬ ਹੀ ਹੋ ਜਾਂਦਾ ਵਾ ਅਤੇ ਤੁਸੀਂ ਕਿਨਾ ਨੀ ਦੱਸੋ ਕੋਈ ਦਵਾਈ ਹਲਦੀ ਹਲਦੀ ਤੱਕ ਕਿਨਾ ਨੀ ਸਾਰੇ ਉੱਥੇ ਮੈਂ ਪਾਉਂਦੀ ਹਾਂ ਉਹਦੇ ਵਿੱਚ ਸਾਰੇ ਪਾਸੇ ਮਿਕਸ ਕਰਕੇ ਵੀ ਚੱਲ ਕਿਸੇ ਤਰ੍ਹਾਂ ਵੀ ਕੀੜਾ ਨਾ ਲੱਗੇ ਉਹ ਫਿਰ ਵੀ ਲੱਗ ਜਾਂਦਾ ਵਾ ਉਹ ਪਤਾ ਨਹੀਂ ਕਿਨਾ ਨੀ ਕਿਉਂ ਲੱਗ ਜਾਂਦਾ ਵਾ ਨਿੰਮ ਘੋਲ ਉਹਦਾ ਪੇਸਟ ਬਣਾ ਕੇ ਉਹ ਵੀ ਮੈਂ ਪਾਉਂਦੀ ਹਾਂ ਵੀ ਚੱਲ ਇਹਦੇ ਕੁੜੱਤਣ ਕਰਕੇ ਵੀ ਚੱਲ ਕੀੜਾ ਨਾ ਲੱਗੇ ਅਤੇ ਉਹ ਫਿਰ ਲੱਗ ਜਾਂਦਾ ਵਾ